ਇਸ ਖੇਤਰ ਵਿੱਚ ਅਕਸਰ ਹੀ ਦੇਖੇ ਜਾਣ ਵਾਲੇ ਪੰਛੀ ਕਾਫੀ ਹਨ ਪਰ ਇਹਨਾਂ ਦੇ ਵਿੱਚੋਂ ਕਬੂਤਰ ਘੁੱਗੀ ਗਟਾਰ ਅਤੇ ਇਹ ਕਾਫੀ ਦੇਖਣ ਨੂੰ ਮਿਲ ਰਹੇ ਹਨ ਖੇਤਾਂ ਦੇ ਵਿੱਚ ਟਟੀਰੀ ਹੋ ਗਈ ਤਿੱਤਰ ਵੀ ਇੱਕ ਪੰਛੀ ਹੈ ਜਿਹੜਾ ਖੇਤਾਂ ਦੇ ਵਿੱਚ ਪਾਇਆ ਜਾਂਦਾ ਹੈ ਇਸ ਤਰ੍ਹਾਂ ਦੇ ਪੰਛੀ ਇੱਥੇ ਬਹੁਤ ਸਾਰੇ ਦੇਖਣ ਨੂੰ ਮਿਲ ਰਹੇ ਹਨ ਅਤੇ ਬਹੁਤ ਹੀ ਜ਼ਿਆਦਾ ਕਾਫੀ ਜਿਹੜੇ ਕਿ ਹੈਗੇ ਜ਼ਿਆਦਾ ਉਸ ਸੰਖਿਆ ਦੇ ਵਿੱਚ ਪਾਏ ਜਾਂਦੇ ਹਨ ਇੱਥੇ ਅਤੇ ਕਾਫੀ ਦੇਖਣ ਨੂੰ ਮਿਲਦੇ ਹਨ ਅਤੇ ਮੋਰ ਵੀ ਇੱਥੇ ਹੁਣ ਜਿਹੜੇ ਕਿ ਸਾਡੇ ਪਿੰਡਾਂ ਦੇ ਵਿੱਚ ਮੋਰਾਂ ਦੀ ਪ੍ਰਜਾਤੀ ਵੀ ਜਿਹੜੀ ਹੁਣ ਕਾਫੀ ਦਿਨੋ ਦਿਨ ਵੱਧ ਰਹੀ ਹੈ ਕਿਉਂਕਿ ਕਈ ਘਰ ਮੋਰਾਂ ਦੇ ਬੱਚੇ ਵੀ ਜਾਣੀ ਕਿ ਉਹਨਾਂ ਦੀ ਪ੍ਰਜਾਤੀ 'ਚ ਵਾਧਾ ਕਰਵਾ ਰਹੇ ਨੇਗੇ ਅਤੇ ਇਸ ਤਰ੍ਹਾਂ ਮੋਰ ਵੀ ਸਾਡੇ ਕਾਫੀ ਦੇਖਣ ਨੂੰ ਮਿਲਦੇ ਨੇ ਅਤੇ ਜਿਹੜਾ ਮੋਰ ਹੈ ਉਹ ਇੱਕ ਸਾਡਾ ਪਸੰਦੀਦਾ ਪੰਛੀ ਹੈ ਪਸੰਦੀਦਾ ਪੰਛੀ ਬਹੁਤ ਸੋਹਣਾ ਪੰਛੀ ਹੈ ਅਤੇ ਬਹੁਤ ਹੀ ਵਧੀਆ ਅਤੇ ਸੁੱਚਾ ਇੱਕ ਪੰਛੀ ਹੈ ਦੇਖਣ 'ਚ ਵੀ ਬਹੁਤ ਸੋਹਣਾ ਲੱਗਦਾ ਹੈ ਕਿਉਂਕਿ ਉਹਨਾਂ ਦੇ ਜਿਹੜੇ ਖੰਭ ਨੇ ਉਹ ਨੀਲੇ ਰੰਗ ਦੇ ਨੇਗੇ ਨੀਲਾ ਰੰਗ ਜਿਹੜਾ ਉਹਨਾਂ ਦੇ ਖੰਭਾਂ ਦਾ ਅਤੇ ਉਹ ਦੇਖਣ ਨੂੰ ਬਹੁਤ ਹੀ ਸੁੰਦਰ ਲੱਗਦੇ ਹਨ ਅਤੇ ਦੇਖ ਕੇ ਵੀ ਲੱਗਦਾ ਕਿ ਯਾਰ ਇਹਨਾਂ ਨੂੰ ਆਪਣੇ ਘਰ ਦਾ ਇੱਕ ਸ਼ਿੰਗਾਰ ਬਣਾਇਆ ਜਾਵੇ ਘਰ ਦੇ ਵਿੱਚ ਰੱਖੇ ਜਾਣ ਅਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪੰਛੀ ਹਨ ਜਿਹੜੇ ਕਿ ਸਾਡੇ ਇੱਥੇ ਅਕਸਰ ਹੀ ਆਸ ਪਾਸ ਪਾਏ ਜਾਂਦੇ ਹਨ ਸਾਡੇ ਖੇਤਰ ਦੇ ਵਿੱਚ ਅਤੇ ਪਰ ਜਿਹੜਾ ਕਿ ਮੋਰ ਹੈ ਉਹ ਸਾਡਾ ਬਹੁਤ ਹੀ ਪਸੰਦੀਦਾ ਪੰਛੀ ਹੈ ਕਿਉਂਕਿ ਮੇਰੇ ਖੁਦ ਪਿੰਡ ਦੇ ਵਿੱਚ ਹੀ ਇੱਕ ਘਰ ਦੇ ਕਾਫੀ ਮੋਰ ਰੱਖੇ ਹੋਏ ਹਨ ਜੋ ਕਿ ਸੁਬਹਾ ਦੇ ਟਾਈਮ ਬੋਲਦੇ ਨੇ ਅਤੇ ਬਹੁਤ ਹੀ ਸੋਹਣੇ ਲੱਗਦੇ ਨੇ